ਮੇਰੇ ਅਨੁਸਾਰ ਯੋਗਾ ਸ਼ੁਰੂ ਕ ਉਮ ਕਰਨ ਦੀ ਉਮਰ ਪੰਜ ਸਾਲ ਤੋਂ ਲੈ ਕੇ ਹੈ ਇਸ ਤੋਂ ਵੱਡੀ ਉਮਰ ਦੇ ਲੋਕ ਯੋਗਾ ਕਰ ਸਕਦੇ ਹਨ ਅਤੇ ਕਿਉਂਕਿ ਜਦੋਂ ਵੀ ਬੱਚੇ ਛੋਟੇ ਉਮਰ ਵਿੱਚ ਹੀ ਯੋਗਾ ਕਰਨ ਲੱਗ ਜਾਂਦੇ ਹਨ ਤਾਂ ਉਹਨਾਂ ਦਾ ਸਰੀਰ ਫਲੈਕਸੀਬਲ ਹੋ ਜਾਂਦਾ ਹੈ ਅਤੇ ਉਹ ਬਹੁਤ ਜ਼ਿਆਦਾ ਰਿਲੈਕਸ ਫੀਲ ਕਰਦੇ ਹਨ ਯੋਗਾ ਕਰਨ ਦੇ ਨਾਲ ਲੋਕ ਬੱਚੇ ਆਪਣੇ ਆਪਣਾ ਧਿਆਨ ਮੋਬਾਈਲ ਵਿੱਚ ਜਾਂ ਕਈ ਹੋਰ ਗਲਤ ਕੰਮਾਂ ਵਿੱਚ ਨਹੀਂ ਲਗਾਉਂਦੇ ਜਿਸ ਨਾਲ ਉਹ ਅਜਿਹੀਆਂ ਚੀਜ਼ਾਂ ਤੋਂ ਬਚੇ ਰਹਿੰਦੇ ਹਨ ਜਿਵੇਂ ਕਿ ਨਸ਼ਾ ਬਿਮਾਰੀਆਂ ਆਦਿ ਅਤੇ ਯੋਗਾ ਕਰਨ ਨਾਲ ਉਹ ਜ਼ਿਆਦਾ ਤੰਦਰੁਸਤ ਵੀ ਰਹਿੰਦੇ ਹਨ ਯ ਯੋਗਾ ਕਰਨ ਜਾਂ ਮੈਡੀਟੇਸ਼ਨ ਕਰਨ ਨਾਲ ਉਹ ਆਪਣੇ ਆਹ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਰੱਬ ਨਾਲ ਮੇਲ ਕਰਦੇ ਹਨ ਅਜਿਹਾ ਕਰਨ ਨਾਲ ਹੀ ਉਹਨਾਂ ਦਾ ਸਰੀਰ ਬਹੁਤ ਜ਼ਿਆਦਾ ਵਧੀਆ ਬਣ ਜਾਂਦਾ ਹੈ ਅਜਿਹਾ ਕਰਨ ਨਾਲ ਉਹਨਾਂ ਦੇ ਮੈਂਟਲੀ ਹੈਲਥ ਵੀ ਇੰਪਰੂਵ ਹੁੰਦੀ ਹੈ ਜਿਸ ਕਰਕੇ ਉਹ ਪੜ੍ਹਾਈ ਵਿੱਚ ਵੀ ਜ਼ਿਆਦਾ ਤੇਜ਼ ਹੋ ਜਾਂਦੇ ਹਨ ਛੋਟੀ ਉਮਰ ਵਿੱਚ ਯੋਗਾ ਕਰਨ ਦੇ ਬਹੁਤ ਜ਼ਿਆਦਾ ਫ਼ਾਇਦੇ ਹਨ ਅਤੇ ਜਦ ਕਿ ਵੱਡੀ ਇਸ ਦੇ ਨਾਲ ਹੀ ਵੱਡੀ ਉਮਰ ਵਿੱਚ ਸੱਠ ਤੋਂ ਉੱਪਰ ਦੇ ਲੋਕਾਂ ਨੂੰ ਵੀ ਯੋਗਾ ਕਰਨ ਦੇ ਬਹੁਤ ਜ਼ਿਆਦਾ ਫਾਇਦੇ ਹਨ ਉਹ ਬਹੁਤ ਜ਼ਿਆਦਾ ਬਿਮਾਰੀਆਂ ਤੋਂ ਦੂਰ ਹੋ ਜਾਂਦੇ ਹਨ ਜਿਵੇਂ ਕਿ ਜੋੜਾਂ ਦਾ ਦਰਦ ਆਦਿ ਇਸ ਦੇ ਨਾਲ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੇ ਚਾਂਸ ਵੀ ਘੱਟ ਜਾਂਦੇ ਹਨ ਧੰਨਵਾਦ